ਹਾਂਜੀ ਗੁੱਡ ਆਫਟਰਨੂਨ ਹਾਂਜੀ ਮੈਂ ਮੇਰਾ ਨਾਮ ਨਿਤੀਸ਼ ਹੈ ਹਾਂਜੀ ਜ਼ਰੂਰ ਸਾਡੇ ਇੱਥੇ ਹੁਸ਼ਿਆਰਪੁਰ ਦੇ ਵਿੱਚ ਵੈਸੇ ਤਾਂ ਹੁਣ ਬਹੁਤ ਸਾਰੀ ਡਿਵੈਲਪਮੈਂਟ ਹੋਈ ਆ ਅਤੇ ਕਈ ਸਾਰੀਆਂ ਜਗ੍ਹਾ ਅ ਗੌਰਮੈਂਟ ਨੇ ਬਣਾਈਆਂ ਘੁੰਮਣ ਵਾਸਤੇ ਜਾਂ ਜੇ ਤੁਸੀਂ ਪਿਕਚਰਸ ਵਗੈਰਾ ਕਲਿੱਕ ਕਰਨੀਆਂ ਜੇ ਤੁਸੀਂ ਜੰਗਲ ਸਫਾਰੀ ਲਈ ਜਾਣਾ ਚਾਹੁੰਦੇ ਹਾਂ ਤਾਂ ਇੱਥੇ ਸਾਡੇ ਹੁਸ਼ਿਆਰਪੁਰ ਦੇ ਵਿਚ ਹੋਣੀ ਹੋਣੀ ਹੁਸ਼ਿਆਰਪੁਰ ਫੋਰੈਸਟ ਜੰਗਲ ਸਫਾਰੀ ਲੋਂਚ ਕੀਤੀ ਗਈ ਆ ਉੱਥੇ ਅ ਤੁਹਾਨੂੰ ਕਾਰ ਦੇ ਵਿੱਚ ਘੁਮਾਇਆ ਜਾਂਦਾ ਤੁਹਾਨੂੰ ਜੰਗਲ ਦਿਖਾਇਆ ਜਾਂਦਾ ਅਤੇ ਤੁਹਾਨੂੰ ਟਰੈਕਿੰਗ ਦੀ ਵੀ ਸੁਵਿਧਾ ਉੱਥੇ ਮਿਲਦੀ ਹੈ ਬਾਕੀ ਜੇ ਤੁਸੀਂ ਸ਼ਹਿਰ ਦੇ ਵਿੱਚ ਕਿਤੇ ਜਾਣਾ ਖਾਣ ਪੀਣ ਬਾਰੇ ਤੁਸੀਂ ਦੇਖਣਾ ਆ ਖਾ ਖਾਣ ਪੀਣ ਦੀ ਜਗ੍ਹਾ 'ਤੇ ਜਾਣਾ ਆ ਤਾਂ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਨੇ ਜਿਵੇਂ ਕਿ ਫੂਡ ਸਟ੍ਰੀਟ ਹੋ ਗਈ ਜਾਂ ਅ ਤੁਸੀਂ ਅ ਹੋਰ ਕਿਤੇ ਵੀ ਲੈ ਲਓ ਦੁਸਹਿਰਾ ਗਰਾਊਂਡ ਉੱਥੇ ਅ ਅ ਹਰ ਵੇਲੇ ਫੇਅਰ ਲੱਗਿਆ ਰਹਿੰਦਾ ਆ ਅਤੇ ਤੁਸੀਂ ਉਥੇ ਘੁੰਮ ਸਕਦੇ ਹੋ ਹਾਂਜੀ ਦੁਬਾਰਾ ਪੁੱਛਿਓ ਇੱਕ ਵਾਰੀ ਆਵਾਜ਼ ਨਹੀਂ ਆ ਰਹੀ ਤੁਹਾਡੀ ਹੁਸ਼ਿਆਰਪੁਰ ਦੇ ਵਿੱਚ ਵੈਸੇ ਤਾਂ ਤੁਸੀਂ ਜਾ ਸਕਦੇ ਇੱਥੇ ਟਾਰਜਨ ਵਰਡ ਜਾ ਜਾਓ ਜਾਂ ਉੱਥੇ ਤੁਹਾਨੂੰ ਬਹੁਤ ਸਾਰੀਆਂ ਜਿੱਦਾਂ ਸਵੀ ਸਵਾਮਿੰਗ ਦੀ ਸੁਵਿਧਾ ਅਵੇਲੇਵਲ ਆ ਉੱਥੇ ਅ ਰਾਈਡਜ਼ ਨੇ ਤੁਸੀਂ ਜਾ ਸਕਦੇ ਆਪਣੇ ਫਰੈਂਡਸ ਨਾਲ ਜਾ ਸਕਦੇ ਫੈਮਲੀ ਨਾਲ ਜਾ ਸਕਦੇ ਹਾਂ ਬਹੁਤ ਵਧੀਆ ਉੱਥੇ ਟਾਈਮ ਸਪੈਂਡ ਹੁੰਦਾ ਆ ਬਾਕੀ ਜੇ ਤੁਸੀਂ ਵਿਲੇਜਸ ਅ ਵਿ ਵਿਜ਼ਿਟ ਕਰਨੇ ਆ ਵਿਲੇਜਸ ਬਹੁਤ ਸੋਹਣੇ ਆ ਸਾਡੇ ਇੱਥੇ ਹੁਸ਼ਿਆਰਪੁਰ ਦੇ ਵਿੱਚ ਇਹ ਖ਼ਾਸੀਅਤ ਆ ਹੁਸ਼ਿਆਰਪੁਰ ਦੀ ਮੰਨੀ ਹੋਈ ਵਿਲੇਜਸ ਦੇ ਵਿੱਚ ਬਹੁਤ ਸਾਰੀਆਂ ਜਿੱਦਾਂ ਕਰੋਪਸ ਸਾਨੂੰ ਦੇਖਣ ਨੂੰ ਮਿਲ ਜੂਗੀਆਂ ਵੀ ਵਧੀਆ ਐਨ ਨੇਚਰ ਦੇ ਵਿੱਚ ਟਾਈਮ ਸਪੈਂਡ ਕਰ ਸਕਦੇ ਆਂ ਹੁਸ਼ਿਆਰਪੁਰ ਦੇ ਵਿੱਚ ਵੈਸੇ ਤਾਂ ਇੱਕ ਅ ਬਹੁਤ ਪੁਰਾਣੀ ਜਗ੍ਹਾ ਆ ਬਜਵਾੜਾ ਫੋਟ ਉੱਥੇ ਬੈਜੂ ਵਾਵੜਾ ਦਾ ਜਨਮ ਹੋਇਆ ਇਸ ਜਗ੍ਹਾ 'ਤੇ ਉਹ ਉਹਨਾਂ ਦੇ ਨਾਮ 'ਤੇ ਰੱਖੀ ਗਈ ਹੈ ਜਗ੍ਹਾ ਅਤੇ ਬਹੁਤ ਮਸ਼ਹੂਰ ਹੈ ਇਹ ਸਪੋਟ ਤੁਸੀਂ ਦੇਖ ਸਕਦੇ ਹੋ ਹਿਸਟੋਰਿਕ ਅਤੇ ਸ਼ੀਸ਼ ਮਹਿਲ ਵੀ ਹੈ ਉੱਥੇ ਵੀ ਤੁਸੀਂ ਜਾ ਸਕਦੇ ਹੋ ਸੂਜੈਸ਼ਨ ਕਿਸ ਚੀਜ਼ ਦੀ ਮਤਲਬ ਕਿੱਦਾਂ ਦੀ ਜਗ੍ਹਾ ਜਾਣਾ ਚਾਹੁੰਦੇ ਆ ਤੁਸੀਂ ਹੋਰ ਹਾਂਜੀ ਹਾਂਜੀ ਰਿਲੀਜਸ ਪਲੇਸਿਸ ਵੀ ਬਹੁਤ ਨੇ ਹੁਸ਼ਿਆਰਪੁਰ ਦੇ ਵਿੱਚ ਗੁਰਦੁਆਰੇ ਬਹੁਤ ਬਣੇ ਹੋਏ ਨੇ ਮੰਦਰ ਵੀ ਨੇ ਇੱਥੇ ਹੁਸ਼ਿਆਰਪੁਰ ਦੇ ਵਿੱਚ ਸ਼ਨੀਦੇਵ ਦਾ ਮੰਦਰ ਬਹੁਤ ਫੇਮਸ ਹੈ ਜੋ ਕਿ ਸ਼ਿਮਲਾ ਪਹਾੜੀ ਕੋਲ ਨੇੜੇ ਆਲਮੋਸਟ ਸਿਟੀ ਦੇ ਆਊਟ ਸਾਈਡ ਇੱਥੇ ਤੁਸੀਂ ਜਾ ਸਕਦੇ ਹੋ ਹਨੂੰਮਾਨ ਮੰਦਰ ਜਾ ਸਕਦੇ ਹੋ ਹਨੂੰਮਾਨ ਜੀ ਦੀ ਬਹੁ ਬਹੁਤ ਵੱਡੀ ਮੂਰਤੀ ਬਣਾਈ ਹੋਈ ਆ ਹੁਸ਼ਿਆਰਪੁਰ ਦੁਸਹਿਰਾ ਗਰਾਉਂਡ ਉਹ ਤੁਸੀਂ ਦੇਖ ਸਕਦੇ ਹੋ ਬਾਕੀ ਕੈਬ ਵੈਸੇ ਤਾਂ ਇੱਥੇ ਐਪਸ ਅਵੇਲੇਬਲ ਨਹੀਂ ਹੈਗੇ ਪਰ ਜਿੱਦਾਂ ਟਰੈਵਲਰਸ ਹੈਗੇ ਆ ਇੱਥੇ ਤੁਸੀਂ ਟੈਕਸੀ ਹਾਇਰ ਕਰ ਸਕਦੇ ਹਾਂ ਪਰ ਤੁਹਾਨੂੰ ਆਨਲਾਈਨ ਮਿਲ ਨਹੀਂ ਮਿਲੂਗੀ ਤੁਹਾਨੂੰ ਪਰਸਨਲੀ ਹਾਇਰ ਕਰਨੀ ਪਊਗੀ ਉਹ

ਹਾਂਜੀ ਵੈਲਕਮ